ਲਿਖਣ ਵਾਸਤੇ ਸਭ ਤੋਂ ਮਹੱਤਵਪੂਰਨ ਤਾਂ ਹੈ ਜੀ ਕਿ ਤੁਸੀਂ ਇੱਕ ਅੱਛਾ ਇਨਵਾਇਰਮੈਂਟ ਸਭ ਤੋਂ ਪਹਿਲਾਂ ਹੋਵੇ ਫਿਰ ਮਾਇੰਡ ਸੈਟ ਬਹੁਤ ਹੋਣਾ ਜ਼ਰੂਰੀ ਹੈ ਲਿਖਣ ਵਾਸਤੇ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਕੋਲ ਇੱਕ ਉਸ ਭਾਸ਼ਾ ਦਾ ਪੂਰਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਬਾਰੇ ਆਪਾਂ ਇਹ ਲਿਖਣਾ ਹੈ ਕੁਛ ਵੀ ਲਿਖਣ ਵਾਸਤੇ ਉਸ ਇੱਕ ਅ ਅੱਛੀ ਸੋਚ ਦਾ ਇੱਕ ਅੱਛੇ ਸਬਜੈਕਟ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ 'ਤੇ ਅਸੀਂ ਬੈਠ ਕੇ ਉਹਦੇ 'ਤੇ ਲਿਖ ਸਕਦੇ ਹੋਈਏ ਅਤੇ ਬਾਕੀ ਇਹ ਕ੍ਰਿਏਟਿਵ ਬਲੋਕ ਬਾਰੇ ਜਾਂ ਵਾਈਟਰਸ ਬਲੋਕ ਬਾਰੇ ਮੈਂ ਨਹੀਂ ਜਾਣਦਾ ਕਿ ਇਹ ਕੀ ਹਨ ਇਸ ਦਾ ਮੇਰੇ ਕੋਲ ਕੋਈ ਅਨੁਭਵ ਨਹੀਂ ਹੈ